ਹੈਲੋ ਗੁਡ ਮੋਰਨਿੰਗ ਹਾਂਜੀ ਹਾਂਜੀ ਬੋਲੋ ਅੱਛਾ ਅੱਛਾ ਹਾਂਜੀ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਸਟਾਫ ਮੈਂਬਰ ਨੂੰ ਭੇਜਦਾ ਕਲਾਸ ਵਿੱਚ ਅਤੇ ਉਹ ਸਾਰੀ ਜਾਣਕਾਰੀ ਮੈਨੂੰ ਦੇ ਦੇਗਾ ਅਤੇ ਆਪਾਂ ਇਸ ਚੀਜ਼ ਵੱਲ ਛੇਤੀ ਧਿਆਨ ਦੇਵਾਂਗੇ ਹਾਂਜੀ ਹਾਂਜੀ ਜ਼ਰੂਰ ਅਤੇ ਮੈਂ ਭੇਜ ਤਾ ਆਪਣੇ ਸਟਾਫ ਮੈਂਬਰ ਨੂੰ ਅਤੇ ਤੁਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਦਿਓ ਅਤੇ ਫਿਰ ਮੈਨੂੰ ਦੱਸ ਦੇਵੇਗਾ ਅਤੇ ਆਪਾਂ ਫਿਰ ਧਿਆਨ ਦਿੰਦੇ ਇਸ ਚੀਜ਼ ਬਾਰੇ ਹਾਂਜੀ ਹਾਂਜੀ ਜ਼ਰੂਰ ਚਲੋ ਓਕੇ ਬਾਏ ਓਕੇ ਬਾਏ